ਇੰਟਰਨੈਟ ਨੇ ਬੈਂਕਿੰਗ ਅਤੇ ਲੈਣ ਦੇਣ ਦੇ ਤਰੀਕੇ ਨੂੰ ਬਹੁਤ ਬਦਲ ਦਿੱਤਾ ਹੈ ਹੁਣ ਲੋਕ ਘਰ ਬੈਠੇ ਆਨਲਾਈਨ ਬੈਂਕਿੰਗ ਰਾਹੀਂ ਆਪਣੇ ਖਾਤੇ ਦੀ ਜਾਂਚ ਪੈਸੇ ਟ੍ਰਾਂਸਫਰ ਬਿੱਲ ਭਰਨ ਅਤੇ ਨਿਵੇਸ਼ ਆਦਿ ਕਰ ਸਕਦੇ ਹਨ ਇਹ ਵਿਅਕਤੀਗਤ ਬੈਂਕ ਦੌਰੇ ਦੀ ਲੋੜ ਘਟਾਉਂਦਾ ਹੈ ਸਮਾਂ ਬਚਾਉਂਦਾ ਹੈ ਅਤੇ ਆਰਥਿਕ ਸਹੂਲਤ ਨੂੰ ਤੇਜ਼ ਅਤੇ ਸੁਗਮ ਬਣਾਉਂਦਾ ਹੈ ਕੁਝ ਇੰਟਰਨੈਟ ਬੈਂਕਿੰਗ ਦੇ ਫਾਇਦੇ ਇਸ ਪ੍ਰਕਾਰ ਹਨ ਜਿਵੇਂ ਕਿ ਇਹ ਬਹੁਤ ਜ਼ਿਆਦਾ ਸਹੂਲਤ ਪ੍ਰੋ ਸਹੂਲਤ ਦਿੰਦਾ ਹੈ ਤੇਜ਼ ਲੈਣ ਦੇਣ ਦੀ ਜਾਂਚ ਹੁੰਦੀ ਹੈ ਬਿਹਤਰ ਨਿਯੰਤਰਨ ਹੁੰਦਾ ਹੈ ਮੱਧ ਤਕਨੀਕੀ ਸੁਰੱਖਿਆ ਹੁੰਦੀ ਹੈ ਪਰ ਬੈਂਕ ਜਾਣ ਦੀ ਲੋੜ ਫਿਰ ਵੀ ਇੱਕ ਇਸ ਲਈ ਪੈਂਦੀ ਹੈ ਕਿਉਂਕਿ ਵੱਡੀਆਂ ਲੈਣ ਦੇਣ ਦਾ ਨਿਵੇਸ਼ ਹੁੰਦਾ ਹੈ ਜਿਵੇਂ ਲੋਕ ਲੈਣਾ ਦੇਣਾ ਐਫ ਐਫ ਡੀ ਆਈ ਐਫ ਆਈ ਡੀ ਜਾਂ ਨਵੇਂ ਖਾਤੇ ਖੋਲ੍ਹਣ ਲਈ ਬੈਂਕ ਵਿੱਚ ਜਾਂਦੇ ਹਨ ਸੇਵਾਵਾਂ ਦਾ ਦਸਤਾਵੇਜ਼ ਦੀ ਪੁਸ਼ਟੀ ਕਰਵਾਉਣ ਦੇ ਲਈ ਲੋਕ ਬੈਂਕ ਵਿੱਚ ਜਾਂਦੇ ਹਨ ਅਸੀਂ ਸਭ ਪੂਰੀ ਤਰ੍ਹਾਂ ਡਿਜ਼ੀਟਲ ਬੈਂਕਿੰਗ ਤਾਂ ਨਹੀਂ ਜਾ ਸਕਦੇ ਬਟ ਗਰੀਬ ਬਜ਼ੁਰਗ ਜਾਂ ਗੈਰ ਟੈਕ ਸਾਵੀ ਲੋਕਾਂ ਲਈ ਆਫਲਾਈਨ ਬੈਂਕ ਅੱਜ ਵੀ ਮਹੱਤਵਪੂਰਨ ਹਨ ਵਿਅਕਤੀਗਤ ਭਰੋਸੇਯੋਗਤਾ ਬਹੁਤ ਲੋਕ ਅਜੇ ਵੀ ਆਫਲਾਈਨ ਬੈਂਕਿੰਗ 'ਤੇ ਜ਼ਿਆਦਾ ਭਰੋਸਾ ਕਰਦੇ ਹਨ ਪਰ ਖੁਦ ਦੇ ਹਿਸਾਬ ਨਾਲ ਮੈਂ ਖੁਦ ਆਨਲਾਈਨ ਬੈਂਕਿੰਗ ਦੇ ਪ੍ਰਤੀ ਜ਼ਿਆਦਾ ਦੇਖਦੀ ਹਾਂ ਕਿਉਂ ਕਿਉਂਕਿ ਆਨਲਾਈਨ ਬੈਂਕਿੰਗ ਇੱਕ ਬਹੁਤ ਹੀ ਅੱਛਾ ਅੱਜ ਦੇ ਟਾਈਮ 'ਤੇ ਨਿਵੇਦਨ ਹੈ